ਹਾਂ ਅਸੀਂ ਆਪਣੇ ਘਰ ਵਿੱਚ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਕਾਫੀ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਾਂ ਸਾਡਾ ਘਰ ਦਾ ਵਿਹੜਾ ਬਹੁਤ ਹੀ ਵੱਡਾ ਹੈ ਅਸੀਂ ਪੰਛੀਆਂ ਨੂੰ ਆਪਣੇ ਵਿਹੜੇ ਜਾਂ ਬਾਗ ਵਿੱਚ ਆਕਰਸ਼ਿਤ ਕਰਨ ਦੇ ਲਈ ਕਈ ਤਰੀਕੇ ਵਰਤਦੇ ਹਾਂ ਜੋ ਸਾਡੇ ਬਾਗ ਵਿੱਚ ਸੁੰਦਰਤਾ ਜੀਵਨ ਨੂੰ ਵਧਾਉਣ ਵਧਾਉਂਦੇ ਹਨ ਮੈਂ ਆਪਣੇ ਵਿਚਾਰ ਸਾਂਝੇ ਕਰਨ ਲੱਗੀ ਹਾਂ ਪਹਿਲਾ ਅਤੇ ਸਭ ਤੋਂ ਮੂਹਰਲਾ ਕਦਮ ਹੈ ਪੰਛੀਆਂ ਲਈ ਖਾਣੇ ਅਤੇ ਪਾਣੀ ਦੀ ਸਹੂਲਤ ਮੁਹੱਈਆ ਕਰਨਾ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਅਸੀਂ ਖਾਣੇ ਵਿੱਚ ਅਨਾਜ ਬੀਜ ਅਤੇ ਫਲਾਂ ਦੀ ਵਰਤੋਂ ਕਰਦੇ ਹਾਂ ਉਹਨਾਂ ਲਈ ਖਾਣ ਪੀਣ ਦੀ ਸਹੂਲਤ ਦੇਣ ਲਈ ਖਾਣੇ ਦੇ ਪੱਤੇ ਸੇਬ ਅੰਗੂਰ ਜਾਂ ਸੁੱਕੇ ਮੱਕੀ ਦੇ ਦਾਣੇ ਵਰਗੇ ਖਾਣੇ ਦੀ ਵਰਤੋਂ ਕਰਦੇ ਹਾਂ ਬਾਗ ਵਿੱਚ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਇੱਕ ਖਾਣਾ ਪਾਣੀ ਦਾ ਸਟੇਸ਼ਨ ਸਟੇਸ਼ਨ ਸਥਾਪਿਤ ਕਰਨ ਕਰਨਾ ਵੀ ਮਹੱਤਵਪੂਰਨ ਪਾਣੀ ਦੇ ਲੇਵਲ ਨੂੰ ਕਾਇਮ ਰੱਖਣ ਲਈ ਤਾਜ਼ਾ ਪਾਣੀ ਦੀ ਇੱਕ ਬਾਉਲ ਜਾਂ ਬਾਲਟੀ ਨੂੰ ਰੋਜ਼ਾਨਾ ਤਰ੍ਹਾਂ ਬਦਲਣਾ ਚਾਹੀਦਾ ਪਾਣੀ ਵਿੱਚ ਕੁਝ ਚਿੱਟੇ ਨਿ ਨਿਚੋੜੀ ਜਾਂ ਮਿੱਟੀ ਦੇ ਗੂ ਗੂਗਲ ਨੂੰ ਵੀ ਹਟਾਇਆ ਜਾ ਹਟਾਇਆ ਜਾਂਦਾ ਹੈ ਜਾਂ ਮਿੱਟੀ ਦੇ ਗੂਗਲ ਨੂੰ ਹਟਾਇਆ ਜਾਂਦਾ ਹੈ ਤਾਂ ਜੋ ਪੰਛੀਆਂ ਨੂੰ ਸਾਫ ਅਤੇ ਤਾਜ਼ਾ ਪਾਣੀ ਮਿਲੇ ਅਤੇ ਪੰਛੀਆਂ ਦੀ ਸੁਰੱਖਿਆ ਦਾ ਅਤੇ ਸੁਖਦਾਈ ਮਹਿਸੂਸ ਕਰਨ ਲਈ ਅਸੀਂ ਬਾਗ ਵਿੱਚ ਪੰਛੀਆਂ ਦੇ ਲਈ ਕੁਝ ਕਾਢੀ ਵਾਲੇ ਬਾਬੂ ਜਾਂ ਲੱਕੜ ਦੇ ਘਰ ਬਣਾਏ ਹੋਏ ਹਨ ਇਹ ਉਹਨਾਂ ਨੂੰ ਬਦਲ ਬਦਲਦੇ ਮੌਕੇ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ ਇਸ ਦੇ ਨਾਲ ਬਾਗ ਵਿੱਚ ਬਿਹਤਰੀਨ ਪਦਾਰਥਾਂ ਦੇ ਨਾਲ ਹਰਿਆਲੀਆਂ ਅਤੇ ਕੁਝ ਸੁੰਦਰ ਫਲਾਂ ਨੂੰ ਵੀ ਉਹ ਗੁਣ ਉਹਨਾਂ ਨੂੰ ਖਿੱਚ ਸਕਦਾ ਹੈ ਕਿਉਂਕਿ ਬਹੁਤ ਸਾਰੇ ਪੰਛੀਆਂ ਨੂੰ ਖਾਣ ਪੀਣ ਦੇ ਖੋਜ ਵਿੱਚ ਸੁਗੰਧਿਤ ਅਤੇ ਖੁਸ਼ਬੂਦਾਰ ਫਲਾਂ ਖਿੱਚੇ ਖਿੱਚਦੇ ਹਨ ਇਸ ਤਰ੍ਹਾਂ ਸਾਡੇ ਬਾਗ ਪੰਛੀਆਂ ਲਈ ਇੱਕ ਆਕਰਸ਼ਿਤ ਸਥਾਨ ਬਣ ਗਏ ਹਨ ਅਤੇ ਸਾਨੂੰ ਉਹਨਾਂ ਦੇ ਦੇ ਸੁਹਾਵਣੇ ਦ੍ਰਿਸ਼ਾਂ ਅਤੇ ਸੰਗੀਤਾਂ ਦਾ ਆਨੰਦ ਮਿਲਦਾ ਹੈ